ਬਾਬਾ ਬੁੱਲ੍ਹੇ ਸ਼ਾਹ ਜੀ ਪੰਜਾਬ ਦੀ ਧਰਤੀ ਦੇ ਵਿੱਚ ਇੱਕ ਇਹੋ ਜਿਹੀ ਸ਼ਖਸੀਅਤ ਨੇ ਜਿਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਪਰਿਚੇ ਦੇ ਮੁਹਤਾਜ ਨਹੀਂ ਹੈਗੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਨੇ ਇਸ ਤਰ੍ਹਾਂ ਦੀਆਂ ਰਚਨਾਵਾਂ ਗਾਈਆਂ ਨੇ ਜਿਸ ਦੇ ਨਾਲ ਨਾ ਕੇ ਆਮ ਜਨ ਨੂੰ ਫਾਇਦਾ ਹੋਇਆ ਹੈ ਬਲਕਿ ਉਸ ਸਮੇਂ ਦੇ ਨਾਲ ਨਾਲ ਅੱਜ ਵੀ ਲੋਕਾਂ ਦੇ ਜੀਵਨ ਵਿੱਚ ਉਹਨਾਂ ਦੀਆਂ ਰਚਨਾਵਾਂ ਦਾ ਬਹੁਤ ਪ੍ਰਭਾਵ ਦੇਖਿਆ ਜਾ ਸਕਦਾ ਹੈ ਬਾਬਾ ਬੁੱਲ੍ਹੇ ਸ਼ਾਹ ਦੀ ਲਿਖੀ ਹੋਈ ਹਰ ਗੱਲ ਇੰਨੀ ਕੁ ਸਹੀ ਹੈ ਜੀਵਨ ਦੇ ਉੱਤੇ ਇੰਨੀ ਕੁ ਢੁੱਕਵੀਆਂ ਗੱਲਾਂ ਨੇ ਕਿ ਉਹ ਉਹਨੂੰ ਆਪਾਂ ਕਿਸੇ ਸਮੇਂ ਦੇ ਵਿੱਚ ਨਹੀਂ ਬੰਨ੍ਹ ਸਕਦੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਬਾ ਬੁੱਲ੍ਹੇ ਸ਼ਾਹ ਜੀ ਨੇ ਜੋ ਕਿਹਾ ਉਹ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਤਾਂ ਲਾਗੂ ਸੀ ਜਾਂ ਤਿੰਨ ਸੌ ਸਾਲ ਦੋ ਸੌ ਸਾਲ ਪਹਿਲੇ ਤਾਂ ਲਾਗੂ ਸੀ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਅੱਜ ਦੇ ਨਵੇਂ ਜ਼ਮਾਨੇ ਦੇ ਵਿੱਚ ਉਹ ਲਾਗੂ ਨਹੀਂ ਹੈ ਇਹ ਨਹੀਂ ਹੋ ਸਕਦਾ ਉਹਨਾਂ ਦੀਆਂ ਰਚਨਾਵਾਂ ਇਸ ਤਰ੍ਹਾਂ ਦੀਆਂ ਨੇ ਕਿ ਉਹਨਾਂ ਦੇ ਵਿੱਚ ਨਾ ਸਿਰਫ ਸਮਾਜਿਕ ਜ਼ਿੰਦਗੀ ਬਲਕਿ ਇੱਕ ਰੂਹਾਨੀ ਜ਼ਿੰਦਗੀ ਦੇ ਬਾਰੇ 'ਚ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਬਾਬਾ ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ ਕਿਸੇ ਇਹ ਨਹੀਂ ਇਹ ਕਿਸੇ ਆਮ ਜਨ ਨੂੰ ਹੀ ਪ੍ਰਭਾਵਿਤ ਕਰਦੀਆਂ ਨੇ ਬਲਕਿ ਉਹਨਾਂ ਦੀਆਂ ਇਹ ਰਚਨਾਵਾਂ ਵੱਡੇ ਵੱਡੇ ਲਿਖਾਰੀਆਂ ਨੂੰ ਵੱਡੇ ਵੱਡੇ ਕਵੀਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਰਹੀਆਂ ਨੇ ਜੇ ਮੈਂ ਆਪ ਦੀ ਗੱਲ ਕਰਾਂ ਤਾਂ ਮੈਂ ਜਦੋਂ ਵੀ ਬਾਬਾ ਬੁੱਲ੍ਹੇ ਸ਼ਾਹ ਦੀ ਕੋਈ ਰਚਨਾ ਪੜ੍ਹਾ ਉਹ ਮੈਨੂੰ ਡੂੰਘੇ ਖਿਆਲਾਂ ਵਿੱਚ ਪਾ ਦਿੰਦੇ ਨੇ ਅਤੇ ਉਹਨਾਂ ਦੇ ਵਿੱਚੋਂ ਦੀ ਉਹਨਾਂ ਡੂੰਘੇ ਖਿਆਲਾਂ ਦੇ ਵਿੱਚੋਂ ਦੀ ਨਿਕਲਣ ਲਈ ਜਦੋਂ ਮੈਂ ਆਪ ਦੀ ਲੇਖਣੀ ਚੁੱਕਦੀ ਹਾਂ ਅਤੇ ਉਹਨੂੰ ਮੈਂ ਕਲਮਬੱਧ ਕਰਨਾ ਚਾਹੁੰਦੀ ਹਾਂ ਅਤੇ ਓਸ ਟਾਈਮ ਦੇ ਉੱਤੇ ਮੇਰਾ ਲਿਖਿਆ ਹਰ ਵਾਕ ਕਿਧਰੇ ਨਾ ਕਿਧਰੇ ਬਾਬਾ ਬੁੱਲ੍ਹੇ ਸ਼ਾਹ ਦੀ ਰਚਨਾ ਤੋਂ ਪ੍ਰਭਾਵਿਤ ਹੋਇਆ ਦਿਖਦਾ ਹੈ